ਜਿਵੇਂ ਕਿ ਅਸੀਂ ਕਲਪਨਾ ਕਰਦੇ ਹਾਂ ਕਿ ਅਸੀਂ ਇੱਕ ਡਰਾਇੰਗ ਤਿਆਰ ਕਰਦੇ ਹਾਂ ਜਿਵੇਂ ਕਿ ਇਸ ਵਿੱਚ ਪਾਣੀ ਬਾਰੇ ਦੱਸਿਆ ਜਾਂਦਾ ਹੈ ਕਿਵੇਂ ਪਾਣੀ ਨੂੰ ਵੇਸਟ ਕੀਤਾ ਜਾਂਦਾ ਹੈ ਡੋਲਿਆ ਜਾਂਦਾ ਹੈ ਉਸ ਦੀ ਸਹੀ ਵਰਤੋਂ ਨਹੀਂ ਹੁੰਦੀ ਉਸ ਦੀ ਡਰਾਇੰਗ ਜਦੋਂ ਅਸੀਂ ਕਰਨ ਲੱਗਦੇ ਹਾਂ ਸੋਚਦੇ ਹਾਂ ਕਿ ਕੋਈ ਕਿਵੇਂ ਕਾਰ ਪਾਣੀ ਧੋ ਰਿਹਾ ਹੈ ਅਤੇ ਬਾਈਕ ਨੂੰ ਧੋ ਰਿਹਾ ਹੈ ਇਸ ਨਾਲ ਪਾਣੀ ਕਿੰਨਾ ਵੇਸਟ ਹੋ ਰਿਹਾ ਹੈ ਅਤੇ ਪਾਣੀ ਦੀ ਸਾਨੂੰ ਬਹੁਤ ਦਾ ਅਹਿਮੀਅਤ ਹੋਣੀ ਚਾਹੀਦੀ ਹੈ ਕਿ ਜਦੋਂ ਸਾਨੂੰ ਪਾਣੀ ਨਹੀਂ ਮਿਲਦਾ ਤਾਂ ਉਦੋਂ ਸਾਨੂੰ ਕਿੰਨਾ ਕੁਝ ਭੋਗਣਾ ਪੈਂਦਾ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਕਰੋ ਕਿ ਪਾਣੀ ਨੂੰ ਡੋਲਿਆ ਨਾ ਜਾਵੇ ਫਾਲਤੂ ਤੋਂ ਉਸ ਦਾ ਸਹੀ ਪ੍ਰਯੋਗ ਕੀਤਾ ਜਾਵੇ ਜਿਵੇਂ ਕਿ ਸੜਕਾਂ 'ਤੇ ਫਾਲਤੂ 'ਚ ਵੀ ਟੂਟੀਆਂ ਉਹ ਚੱਲਦੀਆਂ ਰਹਿੰਦੀਆਂ ਹਨ ਪਾਣੀ ਡੁੱਲਦਾ ਰਹਿੰਦਾ ਹੈ ਗੁਰਦੁਆਰਾ ਮਸਜਿਦ ਜਾਂ ਮੰਦਰਾਂ ਬਾਹਰ ਪਾਣੀ ਕਿਵੇਂ ਡੁੱਲਦਾ ਰਹਿੰਦਾ ਹੈ ਉਸ ਨੂੰ ਸਹੀ ਤਰ੍ਹਾਂ ਸੰਭਾਲਿਆ ਜਾਵੇ ਜਿੱਥੇ ਅਸੀਂ ਪਾਣੀ ਦੇਖਦੇ ਆਂ ਡੁੱਲਦਾ ਹੋਇਆ ਸਾਨੂੰ ਟੂਟੀ ਵਗੈਰਾ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਉਸ ਦਾ ਸਹੀ ਪ੍ਰਯੋਗ ਕਰਨਾ ਚਾਹੀਦਾ ਹੈ ਪਾਣੀ ਸਾਡੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ ਯੋਗਦਾਨ ਹੈ